ਹਾਂ ਮੇਰੀਆਂ ਦੋ ਭੈਣਾਂ ਹਨ ਅਤੇ ਜਿਸ ਤਰ੍ਹਾਂ ਹਰ ਇੱਕ ਬੰਦੇ ਦਾ ਨੇਚਰ ਹੁੰਦਾ ਉਹਨਾਂ ਦਾ ਨੇਚਰ ਵੀ ਮੇਰੇ ਤੋਂ ਥੋੜ੍ਹਾ ਅਲੱਗ ਹੈ ਛੋਟੇ ਵਾਲੀ ਭੈਣ ਬਹੁਤ ਜ਼ਿਆਦਾ ਚਿੜਚਿੜੀ ਹੈ ਅਤੇ ਉਸ ਤੋਂ ਉਲਟ ਜਿਹੜੀ ਬੜੇ ਵਾਲੀ ਭੈਣ ਹੈ ਉਹ ਬਹੁਤ ਹੀ ਜ਼ਿਆਦਾ ਸ਼ਾਂਤ ਹੈ ਅਤੇ ਮੇਰਾ ਸੁਭਾਓ ਥੋੜ੍ਹਾ ਜਿਹਾ ਸ਼ਾਂਤ ਰਹਿਨੇ ਦਾ ਹੈ ਪਰ ਜਦੋਂ ਕਦੀ ਕੋਈ ਛੋਟੀ ਮੋਟੀ ਗੱਲ ਹੁੰਦੀ ਹੈ ਤਾਂ ਕਈ ਵਾਰੀ ਬਹੁਤ ਜ਼ਿਆਦਾ ਹਾਈਪਰ ਹੋ ਜਾਂਦਾ ਹਾਂ